ਸਿੱਖਿਆ ਦੇ ਖੇਤਰ ਵਿੱਚ ਪੰਜਾਬ ਵੀ ਬਹੁਤ ਅੱਗੇ ਹੈ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਪ੍ਰਮੁੱਖ ਯੂਨੀਵਰਸ਼ਿਟੀਆਂ ਅਤੇ ਬਹੁਤ ਹੀ ਪ੍ਰਸਿੱਧ ਕੋਲਜ ਹਨ ਅਗਰ ਗੱਲ ਕੀਤੀ ਜਾਵੇ ਯੂਨੀਵਰਸ਼ਿਟੀਆ ਦੇ ਵਿੱ ਦੀ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਮੁੱਖ ਅਤੇ ਪ੍ਰਸਿੱਧ ਯੂਨੀਵਰਸ਼ਿਟੀਆਂ ਹਨ ਉਹ ਹਨ ਗੁਰੂ ਨਾਨਕ ਦੇਵ ਯੂਨੀਵਰਸ਼ਿਟੀ ਅੰਮ੍ਰਿਤਸਰ ਲਵਲੀ ਪ੍ਰੋਫੈਸ਼ਨਲ ਯੂਨੀਵਰਸ਼ਿਟੀ ਜਲੰਧਰ ਪੰਜਾਬ ਟੈਕਨੀਕਲ ਯੂਨੀਵਰਸ਼ਿਟੀ ਕਪੂਰਥਲਾ ਚੰਡੀਗੜ੍ਹ ਯੂਨੀਵਰਸ਼ਿਟੀ ਗੁਰੂ ਨਾਨਕ ਯੂਨੀਵਰਸ਼ਿਟੀ ਅਤੇ ਹੋਰ ਵੀ ਬਹੁਤ ਸਾਰੀਆਂ ਯੂਨੀਵਰਸ਼ਿਟੀਆਂ ਹਨ ਜਿਵੇਂ ਕਿ ਪੰਜਾਬੀ ਯੂਨੀਵਰਸ਼ਿਟੀ ਪਟਿਆਲਾ ਆਦਿ ਅਗਰ ਕੋਲਜਾਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਆਪਣੇ ਇਲਾਕੇ ਦੇ ਜਾਣੀ ਕਿ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦੇ ਕੋਲਜਾਂ ਦੀ ਗੱਲ ਕਰਾਂਗੀ ਸਾਡੇ ਇਲਾਕੇ ਦੇ ਵਿੱਚ ਮੇਨ ਜੋ ਕੋਲਜ ਹਨ ਉਹ ਹਨ ਆਰ ਕੇ ਆਰੀਆ ਕੋਲਜ ਬੀ ਐੱਲ ਐੱਮ ਗਰਲਸ ਕੋਲਜ ਡੀ ਏ ਐੱਨ ਕੋਲਜ ਔਫ ਵੁਮੈਨਸ ਕੇ ਸੀ ਕੋਲਜ ਅਤੇ ਸਿੱਖ ਨੈਸ਼ਨਲ ਕੋਲਜ ਪਰ ਮੈਂ ਅੱਜ ਆਪਣੇ ਕੋਲਜ ਕੇ ਸੀ ਗਰੁੱਪ ਔਫ ਇੰਸਟੀਟਿਊਸ਼ਨ ਦੀ ਗੱਲ ਕਰਨਾ ਚਾਹਵਾਂਗੀ ਮੈਂ ਕੇ ਸੀ ਗਰੁੱਪ ਔਫ ਇੰਸਟੀਟਿਊਸ਼ਨ ਦੇ ਵਿੱਚ ਹੀ ਆਪਣੀ ਪੜ੍ਹਾਈ ਕੀਤੀ ਹੈ ਇਹ ਇੱਕ ਬਹੁਤ ਵੱਡਾ ਅਤੇ ਬਹੁਤ ਹੀ ਚੰਗਾ ਕੋਲਜ ਹੈ ਇਸ ਕੋਲਜ ਦੇ ਵਿੱਚ ਲਗਭਗ ਛੇ ਕੋਲਜ ਅੰਡਰ ਆਉਂਦੇ ਹਨ ਜਿੱਦਾਂ ਕਿ ਮੈਨੇਜਮੈਂਟ ਕੋਲਜ ਹੋਟਲ ਮੈਨੇਜਮੈਂਟ ਕੋਲਜ ਫਾਰਮੈਸੀ ਕੋਲਜ ਇੰਜੀਨੀਅਰਿੰਗ ਕੋਲਜ ਪੋਲੀਟੈਕਨਿਕ ਕੋਲਜ ਆਯੁਰਵੇਦਾ ਕੋਲਜ ਕੇ ਸੀ ਕੋਲਜ ਦੇ ਵਿੱਚ ਬਹੁਤ ਹੀ ਸਾਰੀਆਂ ਕੋਰਸਿਸ਼ ਉਪਲਬਧ ਹਨ ਜਿਵੇਂ ਕਿ ਇੰਜੀਨੀਅਰਿੰਗ ਕੋਲਜ ਦੇ ਵਿੱਚ ਸਿਵਲ ਇੰਜੀਨੀਅਰਿੰਗ ਸੀ ਐੱਸ ਸੀ ਕਰਵਾਈ ਜਾਂਦੀ ਹੈ ਪੋਲੀਟੈਕਨਿਕ ਯੂਨੀਵ ਕੋਲਜ ਦੇ ਵਿੱਚ ਮਕੈਨੀਕਲ ਇਲੈਕਟ੍ਰਿਕ ਆਦਿ ਦੇ ਕੋਰਸਿਸ ਕੀਤੇ ਜਾਂਦੇ ਹਨ ਬਹੁਤ ਸਾਰੇ ਡਿਪਲੋਮੇ ਕੋਰਸਿਸ ਕਰਵਾਏ ਜਾਂਦੇ ਹਨ ਫਾਰਮੈਸੀ ਦੀ ਗੱਲ ਕੀਤੀ ਜਾਵੇ ਤਾਂ ਬੀ ਫੋਰਮੈਸੀ ਡੀ ਫੋਰਮੈਸੀ ਅਤੇ ਫਾਰਮੈਸੀ ਡਿ ਡਿਪਲੋ ਡਿਪਲੋਮੇ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਬੀ ਸੀ ਏ ਐੱਮ ਬੀ ਏ ਬੀ ਬੀ ਏ ਬੀ ਐੱਸ ਸੀ ਐਗਰੀਕਲਚਰ ਅਤੇ ਕੰਪਿਊਟਰ ਆਦਿ ਦੇ ਡਿਪਲੋਮੇ ਵੀ ਕਰਵਾਏ ਜਾਂਦੇ ਹਨ ਅਤੇ ਸਭ ਤੋਂ ਜ਼ਿਆਦਾ ਵਿਦਿਆਰਥੀ ਅੱਜ ਕੱਲ੍ਹ ਹੋਟਲ ਮੈਨੇਜਮੈਂਟ ਦੇ ਵਿੱਚ ਜ਼ਿਆਦਾ ਇੰਟਰਸਟ ਲੈਂਦੇ ਹਨ ਹੋਟਲ ਮੈਨੇਜਮੈਂਟ ਦੇ ਕਾਫੀ ਸਾਰੇ ਡਿਪਲੋਮੇ ਕਰਵਾਏ ਜਾਂਦੇ ਹਨ